ਕਿਸੇ ਵੀ ਕੰਪਨੀ ਦੇ ਹੈਲਥ ਇਨਸ਼ੋਰੈਂਸ ਲੈਣ ਤੋਂ ਪਹਿਲਾਂ ਆਪਾਂ ਨੂੰ ਉਸ ਦੀਆਂ ਸ਼ਰਤਾਂ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਚਾਹੀਦਾ ਹੈ ਮੈਂ ਕੁਛ ਸਮਾਂ ਪਹਿਲਾਂ ਆਪਣੀ ਹੈਲਥ ਇੰਸ਼ੋਰੈਂਸ ਕਰਵਾਈ ਸੀ ਤਾਂ ਮੇਰਾ ਸੁਝਾਉ ਹੈ ਕਿ ਤੁਸੀਂ ਇਹ ਐਲ ਐਮ ਕੰਪਨੀ ਦੇ ਇੰਸ਼ੋਰੈਂਸ ਕਰਵਾਓ ਜਿਸ ਵਿੱਚ ਸਭ ਤੋਂ ਜ਼ਿਆਦਾ ਹੋਸਪਿਟਲ ਸ਼ਾਮਿਲ ਹਨ ਪ੍ਰੀਮੀਅਮ ਵੀ ਬਾਕੀ ਕੰਪਨੀਆਂ ਦੇ ਮੁਕਾਬਲੇ ਘੱਟ ਹੈ ਅਤੇ ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਜੇਕਰ ਆਪਾਂ ਪਹਿਲੇ ਸਾਲ ਕੋਈ ਕਲੇਮ ਨਹੀ ਲੈਂਦੇ

ਦੂਜੇ ਸਾਲ ਤੋਂ ਆਪਣਾ ਕਲੇਮ ਦੋ ਗੁਣਾ ਹੋ ਜਾਂਦਾ ਹੈ ਜਿਸ ਤਰ੍ਹਾਂ ਆਪਾਂ ਪੰਜ ਲੱਖ ਦਾ ਬੀਮਾ ਕਰਵਾਇਆ ਹੈ ਅਤੇ ਆਪਾਂ ਪਹਿਲੇ ਸਾਲ ਕੋਈ ਕਲੇਮ ਨਹੀਂ ਲਿਆ ਤਾਂ ਅਗਲੇ ਸਾਲ ਆਪਣਾ ਬੀਮਾ ਵੱਧ ਕੇ ਦਸ ਲੱਖ ਤੱਕ ਦਾ ਹੋ ਜਾਵੇਗਾ ਜੋ ਕਿ ਇੱਕ ਬਹੁਤ ਵੱਡੀ ਸੁਵਿਧਾ ਹੈ